ਕਰੋਨਾ ਟਾਈਮ 'ਚ ਸਾਡੀ ਜ਼ਿੰਦਗੀ 'ਚ ਬਹੁਤ ਮੁਸੀਬਤਾਂ ਆਈਆਂ ਬਹੁਤ ਮੁਸ਼ਕਲਾਂ ਆਈਆਂ ਜਿਸ ਕਰਕੇ ਸਾਨੂੰ ਇਸ ਟਾਈਮ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਕਿਤੇ ਜਾ ਵੀ ਨਹੀਂ ਸਕਦੇ ਸੀਗੇ ਜਦੋਂ ਘਰ 'ਚ ਆਟਾ ਖਤਮ ਹੋ ਗਿਆ ਆਟਾ ਵੀ ਨਹੀਂ ਮਿਲਦਾ ਸੀਗਾ ਦਾਲਾਂ ਖਤਮ ਹੋ ਗਈ ਦਾਲਾਂ ਵੀ ਨਹੀਂ ਮਿਲਦੀਆਂ ਸੀਗੀਆਂ ਦੁਕਾਨਦਾਰੀਆਂ ਬੰਦ ਪਈਆਂ ਸੀਗੀਆਂ ਬੱਚਿਆਂ ਵਾਸਤੇ ਦੁੱਧ ਨਹੀਂ ਸੀਗਾ ਦੋ ਦੋਝੀ ਆਉਂਦੇ ਨਹੀਂ ਸੀਗੇ ਜੇ ਲੈਣਾ ਸੀਗਾ ਤਾਂ ਬੰਦੇ ਵਹਿਮ ਕਰਦੇ ਸੀਗੇ ਦੂਜੇ ਤੋਂ ਕਰੋਨਾ ਨਾ ਹੋ ਜਾਵੇ ਇਸ ਕਰਕੇ ਬੱਚਿਆਂ ਨੂੰ ਪਾਣੀ ਦੇ ਨਾਲ ਹੀ ਟਾਈਮ ਕੱਢਣਾ ਪਿਆ ਜੇ ਕਦੇ ਰਿਸ਼ਤੇਦਾਰ 'ਚ ਜਾਣਾ ਪਿਆ ਤਾਂ ਉੱਥੇ ਜਾ ਨਹੀਂ ਸਕਦੇ ਸੀਗੇ ਇਸ ਕਰੋਨਾ ਟਾਈਮ 'ਚ ਸਾਡੇ ਰਿਸ਼ਤੇਦਾਰਾਂ ਚ ਡੈੱਥ ਹੋ ਗਈ ਸੀ ਡੈੱਥ ਦੇ ਕਾਰਨ ਸਾਨੂੰ ਸਾਈਕਲਾਂ 'ਤੇ ਜਾਣਾ ਪਿਆ ਕਿਉਂਕਿ ਕੋਈ ਗੱਡੀ ਨਹੀਂ ਸੀਗੀ ਕੋਈ ਬੱਸਾਂ ਨਹੀਂ ਸੀਗੀਆਂ ਸਾਈਕਲਾਂ 'ਤੇ ਜਾ ਕੇ ਸਾਨੂੰ ਦਾਹ ਸੰਸਕਾਰ 'ਤੇ ਜਾਣਾ ਪਿਆ ਉਹਨਾਂ ਦਾਹ ਸੰਸਕਾਰ ਕਰਕੇ ਆਏ ਇਸ ਕਰਕੇ ਬਹੁਤ ਮੁਸੀਬਤਾਂ ਆਈਆਂ ਬੱਚਿਆਂ ਨੂੰ ਜੇ ਕਿਤੇ ਬਾਹਰ ਘੁੰਮਣ ਜਾਣਾ ਤਾਂ ਮਾਸਕ ਲਗਾਉਣਾ ਪੈਂਦਾ ਸੀਗਾ ਮਾਸਕ ਦੇ ਰੇਟ ਵੀ ਇੰਨੇ ਉਸੇ ਜੋ ਦੋ ਰੁਪਏ ਦਾ ਮਾਸਕ ਸੀਗਾ ਕਰੋਨਾ ਟਾਈਮ 'ਚ ਦਸ ਦਸ ਰੁਪਏ ਦੇ ਵਿਕੇ ਹਨ ਜਿਸ ਕਰਕੇ ਬੱਚੇ ਕੰਮ ਕਾਰ ਨਹੀਂ ਸੀਗੇ ਅਤੇ ਖਰਚਾ ਤਾਂ ਉੱਨਾਂ ਹੀ ਸੀਗਾ ਖਰਚਾ ਖਰਚਾ ਕਰਨਾ ਪੈਂਦਾ ਸੀਗਾ ਰੋਟੀ ਤਾਂ ਖਾਣੀ ਹੀ ਸੀਗੀ ਰੋਟੀ ਨਾ ਖਾਈਏ ਤਾਂ ਬੱਚੇ ਊਂ ਬਿਮਾਰ ਹੋ ਜਾਂਦੇ ਸੀਗੇ ਕਰੋਨਾ ਟਾਈਮ 'ਚ ਬੱਚਿਆਂ ਨੂੰ ਕਾਫੀ ਬੱਚਿਆਂ ਦਾ ਰੋਟੀ ਵੀ ਨਹੀਂ ਮਿਲੀ ਜੋ ਕੰਮ ਕਰਨ ਨਾਲ ਕਰਨ ਵਾਲ਼ੇ ਸੀਗੇ ਕਿਉਂਕਿ ਕੰਮ ਕਾਰ ਸਾਰੇ ਬੰਦ ਸੀਗੇ ਕੰਮ ਕਾਰ ਬੰਦ ਹੋਣ ਕਾਰਨ ਪੈਸੇ ਦੀ ਬਹੁਤ ਪ੍ਰੋਬਲਮ ਆਈ ਜਿਸ ਕਰਕੇ ਬੱਚੇ ਬਹੁਤ ਬਿਮਾਰ ਹੋਏ ਅਤੇ ਬੱਚਿਆਂ ਨੂੰ ਖਾਣ ਨੂੰ ਰੋਟੀ ਵੀ ਨਸੀਬ ਨਹੀਂ ਹੋਈ